ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੋਹਾਲੀ ਗ੍ਰੇ ਮੈਟਰ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਨੂੰ ਨਾ ਕੁਝ ਜਾਣਕਾਰੀ ਚਾਹੀਦੀ ਸੀ ਜੀ ਹਾਂਜੀ ਮੈਂ ਨਾ ਕਨੇਡਾ ਜਾਣਾ ਚਾਹੁੰਦੀ ਹਾਂ ਔਰ ਨਾ ਮੈਨੂੰ ਪਤਾ ਕਰਨਾ ਸੀਗਾ ਕਿ ਆਈਲੈਟਸ ਵਿੱਚ ਕਿੰਨੇ ਬੈਂਡਾਂ ਦੀ ਲੋੜ ਹੈ ਕਨੇਡਾ ਜਾਣ ਲਈ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਹਾਂਜੀ ਮੈਂ ਕਮਰਸ ਵਿੱਚ ਕਰੀ ਹੋਈ ਹੈ ਜੀ ਪਲੱਸ ਟੂ ਔਰ ਮੈਂ ਹਾਂਜੀ ਮੈਂ ਦੋ ਹਜ਼ਾਰ ਬਾਈ 'ਚ ਕੀਤੀ ਸੀਗੀ ਪਲੱਸ ਟੂ ਪਾਸ ਹਾਂਜੀ ਮੇਰੇ ਅੱਸੀ ਪਰਸੈਂਟ ਨੰਬਰ ਬਣਦੇ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਜੀ ਚਲੋ ਮੈਂ ਕੱਲ ਆ ਕੇ ਪਤਾ ਕਰ ਲਵਾਂਗੀ ਜੀ ਫੇਰ ਤੁਹਾਡੇ ਔਫਿਸ ਹਾਂ ਠੀਕ ਹੈ ਠੀਕ ਹੈ ਓਕੇ ਠੀਕ ਹੈ ਜੀ ਠੀਕ ਹੈ ਜੀ ਓ ਠੀਕ ਹੈ ਜੀ ਓਕੇ